ਖੇਡਾਂ ਜਿੰਦਗੀ ਦਾ ਬਹੁਤ ਹੀ ਮਹੱਤਵਪੂਰਨ ਭਾਗ ਹੈ ਪਟਿਆਲੇ ਵਿੱਚ ਖੇਡਾਂ ਦਾ ਬਹੁਤ ਹੀ ਮਹੱਤਵ ਹੈ ਅਤੇ ਬਹੁਤ ਹੀ ਜ਼ਿਆਦਾ ਭਰਪੂਰ ਹੈ ਕਿਉਂਕਿ ਪਹਿਲਾਂ ਜਿਹੜੇ ਵੀ ਮਹਾਰਾਜੇ ਰਹੇ ਹਨ ਉਹਨਾਂ ਨੇ ਪਟਿਆਲੇ ਵਿੱਚ ਖੇਡਾਂ ਲਈ ਐੱਨ ਐੱਸ ਏ ਸਟੇਡੀਅਮ ਪੋਲੋ ਗਰਾਉਂਡ ਵਗੈਰਾ ਬਣਾਏ ਹਨ ਜਿੰਨਾ ਜਿੱਥੇ ਕਿ ਹਰ ਇੱਕ ਖੇਡ ਦਾ ਪ੍ਰਬੰਧ ਹੈ ਜਿਸ ਤਰ੍ਹਾਂ ਲਾ ਲਓ ਕਿ ਉੱਥੇ ਆਪਾਂ ਜਾਦੇ ਹਾਂ ਅਤੇ ਮੈਨੂੰ ਲੱਗਦਾ ਕਿ ਉਹ ਤਕਰੀਬਨ ਸੌ ਕਿੱਲੇ 'ਚ ਬਣਿਆ ਹੋਊਗਾ ਪੋਲੋ ਗਰਾਊਂਡ ਲਾ ਲਓ ਉਹਦੇ ਵਿੱਚ ਸਾ ਆਪਣਾ ਹਾਕੀ ਦਾ ਅਤੇ ਫੁੱਟਬੋਲ ਦਾ ਅਤੇ ਵਾਲੀਬੋਲ ਦਾ ਹਰ ਇੱਕ ਤਰ੍ਹਾਂ ਦਾ ਅੱਡ ਅੱਡ ਗਰਾਊਂਡ ਬਣਿਆ ਹੋਇਆ ਖੇਡਣ ਵਾਸਤੇ ਅਸੀਂ ਜਦੋਂ ਵੀ ਜਾਂਦੇ ਹਾਂ ਖੇਡਣ ਉੱਥੇ ਆਪਣਾ ਤਾਂ ਬੱਚੇ ਕੋਈ ਨਾ ਕੋਈ ਗੇਮ ਖੇਡ ਰਹੇ ਹੁੰਦੇ ਨੇ ਬੋਕਸਿੰਗ ਦਾ ਟਰੈਕ ਬਣਿਆ ਹੋਇਆ ਹੈ ਅਤੇ ਜੇ ਹਰ ਇੱਕ ਤਰ੍ਹਾਂ ਦੇ ਬੱਚੇ ਅਤੇ ਭਾਈਚਾਰੇ ਦੇ ਲੋਕ ਉੱਥੇ ਆ ਕੇ ਖੇਡਦੇ ਹਨ ਗੇਮਾਂ ਕੋਈ ਨਾ ਕੋਈ ਅਤੇ ਜਿਹੜੇ ਵੀ ਕੋਈ ਵੱਡੇ ਵੱਡੇ ਕੰਪਟੀਸ਼ਨ ਜਿਵੇਂ ਮੰਨ ਲਓ ਕੋਈ ਸਟੇਟ ਦੀਆਂ ਖੇਡਾਂ ਹੋ ਗਈਆਂ ਡਿਸਟਰਿਕਟ ਲੈਵਲ ਦੀਆਂ ਖੇਡਾਂ ਹੋ ਗਈਆਂ ਉਹ ਪੋਲੋ ਗਰਾਉਂਡ ਪਟਿਆਲੇ ਦੇ ਵਿੱਚ ਹੁੰਦੀਆਂ ਨੇ ਖਾਸ ਕਰ ਪਟਿਆਲੇ ਦੇ ਵਿੱਚ ਤਾਂ ਐੱਨ ਐੱਸ ਐੱਸ ਹੈ ਬਣਿਆ ਹੋਇਆ ਸਪੋਰਟਸ ਦਾ ਜਿੱਥੇ ਕੀ ਬਾਹਰਲੇ ਦੇਸ਼ ਦੇ ਖਿਡਾਰੀ ਆਪਣੇ ਸਟੇਟਾਂ ਦੇ ਆਉਂਦੇ ਨੇ ਪੜ੍ਹਾਈ ਕਰਦੇ ਨੇ ਅਤੇ ਉੱਥੋਂ ਜਾ ਕੇ ਅੱਗੇ ਅਗਾਂਹ ਖੇਡਦੇ ਨੇ ਬਾਹਰਲੇ ਦੇਸ਼ਾਂ ਨਾਲ ਫਿਰ ਉਸ ਤੋਂ ਬਾਅਦ ਉਹਨਾਂ ਦੀ ਤਰੱਕੀ ਹੁੰਦੀ ਹੈ ਕਿ ਉਹਨਾਂ ਨੂੰ ਇਸ ਤੋਂ ਨੌਕਰੀ ਮਿਲਦੀ ਹੈ ਇਸੇ ਤਰ੍ਹਾਂ ਯਾਦਵਿੰਦਰਾ ਸਪੋਰਟ ਸਟੇਡੀਅਮ ਆ ਜਿੱਥੇ ਸ਼ੂਟਿੰਗ ਦਾ ਹੈ ਅਤੇ ਨਾਲ ਹੀ ਪਟਿਆਲੇ ਵਿੱਚ ਘੋੜ ਸਵਾਰੀ ਦਾ ਬਹੁਤ ਹੀ ਜ਼ਿਕਰ ਹੁੰਦਾ ਹੈ ਜੋ ਕਿ ਸ਼ਾਹੀ ਲੋਕ ਹੈ ਜੋ ਵਿਦਿਆਰਥੀ ਨੇ ਉਹ ਸ਼ੂਟਿੰਗ ਅਤੇ ਆਪਣਾ ਘੋੜ ਸਵਾਰੀ ਕਰਦੇ ਹਨ